ਦੌੜ ਨਾਲ ਸਾਡੀ ਮਾਨਸਿਕ ਅਤੇ ਸਿਹਤ ਤੰਦਰੁਸਤ ਰਹਿੰਦੀ ਹੈ ਪਰ ਆਪਾਂ ਨੂੰ ਹਮੇਸ਼ਾ ਤਰੀਕੇ ਨਾਲ ਹੀ ਦੌੜਨਾ ਚਾਹੀਦਾ ਹੈ ਕਦੇ ਵੀ ਨੰਗੇ ਪੈਰੀ ਨਹੀਂ ਦੌੜਨਾ ਚਾਹੀਦਾ ਕਿਉਂਕਿ ਨੰਗੇ ਪੈਰੀ ਦੌੜਨ ਨਾਲ ਆਪਾਂ ਸਿਹਤ ਵਿਗਾੜ ਬੈਠਦੇ ਹਾਂ ਅਤੇ ਦੂਸਰਾ ਆਪਾਂ ਨੂੰ ਹਮੇਸ਼ਾ ਵਧੀਆ ਗਰਾਊਂਡ ਜਾਂ ਕੋਈ ਵੀ ਕੱਚੇ ਰਾਹ 'ਤੇ ਦੌੜਨਾ ਚਾਹੀਦਾ ਹੈ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਪੱਕੀ ਸੜਕ 'ਤੇ ਨਹੀਂ ਦੌੜਨਾ ਚਾਹੀਦਾ ਪੱਕੀ ਸੜਕ 'ਤੇ ਦੌੜਨਾ ਪਹਿਲਾਂ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਵਾਹਨ ਨਾ ਕੋਈ ਹੋਵੇ ਕਿਉਂਕਿ ਪੱਕੀ ਸੜਕਾਂ 'ਤੇ ਜ਼ਿਆਦਾਤਰ ਵਾਹਨ ਆਉਂਦੇ ਹਨ ਅਤੇ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੈ ਜੇ ਆਪਾਂ ਕਿਸੇ ਗਰਾਊਂਡ 'ਚ ਦੌੜਾਂਗੇ ਤਾਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚੋਟ ਆਉਣ ਤੋਂ ਬਚੇ ਰਹਾਂਗੇ ਅਤੇ ਦੂਸ ਆਪਾਂ ਨੂੰ ਹਮੇਸ਼ਾ ਸਵੇਰੇ ਜਾਂ ਸ਼ਾਮ ਨੂੰ ਹੀ ਦੌੜਨਾ ਚਾਹੀਦਾ ਹੈ ਕਿਉਂਕਿ ਇਸ ਟਾਈਮ ਵਾਤਾਵਰਨ ਸਾਫ ਰਹਿੰਦਾ ਹੈ ਅਤੇ ਆਪਣੀ ਹਵਾ ਸਾਫ ਰਹਿੰਦੀ ਹੈ ਇਸ ਨਾਲ ਕਿ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਬਚਾਅ ਰਹਿੰਦਾ ਹੈ